ਹਾਂਜੀ ਮੈਂ ਐਕਚੁਲੀ ਮੈਂ ਜ਼ਿਆਦਾਤਰ ਆਪਣੀ ਜੇ ਮੈਂ ਕਦੇ ਵੀ ਮੈਂ ਕੋਈ ਬਿਮਾਰ ਜਾਂ ਮੈਨੂੰ ਕੋਈ ਜ਼ੁਕਾਮ ਅਤੇ ਕੋਈ ਵੀ ਛੋਟੀ ਜਿਹੀ ਵੀ ਬਿਮਾਰੀ ਹੁੰਦੀ ਤਾਂ ਮੋਸਟਲੀ ਤਾਂ ਮੈਂ ਜ਼ਿਆਦਾਤਰ ਹੀ ਕਰਦਾ ਕਿ ਮੈਂ ਵਧੀਆ ਜਿਹੇ ਡਾਕਟਰ ਕੋਲ ਜਾ ਕੇ ਚੈੱਕਅਪ ਕਰਾਵਾਂ ਡਾਇਗਨਸ ਕਰਾਵਾਂ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਬਿਮਾਰੀ ਹੋਈ ਕਿਉਂ ਹੈ ਮੈਂ ਬੜੇ ਘੱਟ ਹੀ ਨੁਸਖੇ ਅਪਣਾਉਂਦਾ ਕਿਉਂਕਿ ਐਕਚੁਲੀ ਮੇਰੇ ਪਰਿਵਾਰ ਦੇ ਵਿੱਚ ਬਾਕੀ ਸਾਰੇ ਤਾਂ ਮੇਰਾ ਭਰਾ ਵੱਡਾ ਭਰਾ ਹੋ ਗਿਆ ਜਾਂ ਮੇਰੇ ਮੰਮੀ ਡੈਡੀ ਹੋ ਗਏ ਉਹ ਸਾਰੇ ਜ਼ਿਆਦਾਤਰ ਘਰ ਦੇ ਵਿੱਚ ਹੀ ਜੋ ਘਰ ਘਰੇਲੂ ਨੁਸਖੇ ਹੁੰਦੇ ਨੇ ਉਹਨਾਂ 'ਤੇ ਵਿਸ਼ਵਾਸ ਰੱਖਦੇ ਨੇ ਪਰ ਮੈਂ ਇੰਨਾ ਨਹੀਂ ਵਿਸ਼ਵਾਸ ਰੱਖਦਾ ਮੈਨੂੰ ਥੋੜ੍ਹਾ ਡਰ ਜਿਹਾ ਲੱਗਿਆ ਰਹਿੰਦਾ ਕਿ ਮੈਨੂੰ ਕੁਛ ਹੋ ਨਾ ਜਾਵੇ ਇਸ ਲਈ ਮੈਂ ਜਲਦੀ ਤੋਂ ਜਲਦੀ ਵਧੀਆ ਡਾਕਟਰ ਕੋਲ ਜਾ ਕੇ ਦਵਾਈ ਲੈਣਾ ਪਸੰਦ ਕਰਦਾ ਬਾਕੀ ਅੱਜ ਤੱਕ ਵੈਸੇ ਜ਼ਿਆਦਾ ਬਿਮਾਰ ਤਾਂ ਮੈਂ ਹੋਇਆ ਨਹੀਂ ਪਰ ਤਾਂ ਵੀ ਘਰ ਘਰੇਲੂ ਨੁ ਨੁਸਖਿਆਂ ਤੋਂ ਤਾਂ ਮੈਂ ਜਿਆ ਘੱਟ ਹੀ ਕਰਦਾਂ ਇਸ ਤੋਂ ਇਲਾਵਾ ਜ਼ਿਆਦਾਤਰ ਜੇ ਮੈਂ ਕੋਈ ਨੁਸਖੇ ਵਰਤਦਾ ਵੀ ਹਾਂ ਜਿਵੇਂ ਤੁਸੀਂ ਪੁੱਛਿਆ ਕਿ ਮੈਂ ਘਰ ਦੇ ਵਿੱਚ ਅਗਰ ਜੇ ਕੋਈ ਨੁਸਖੇ ਵਰਤਦਾ ਤਾਂ ਉਹਨਾਂ ਬਾਰੇ ਦੱਸੋ ਤਾਂ ਉਸ ਵਿੱਚ ਤਾਂ ਮੈਂ ਜ਼ਿਆਦਾਤਰ ਜਿਹੜਾ ਕਾੜ੍ਹਾ ਹੁੰਦਾ ਨਾ ਕਾੜ੍ਹਾ ਕਾੜ੍ਹਾ ਪੀਣਾ ਪਸੰਦ ਕਰਦਾ ਉਸਦੇ ਵਿੱਚ ਤੁਹਾਨੂੰ ਪਤਾ ਪਾਣੀ ਦੇ ਵਿੱਚ ਗੁੜ ਪਾ ਕੇ ਇਲਾਇਚੀ ਪਾ ਕੇ ਲੌਂਗ ਪਾ ਕੇ ਕਾਲੀ ਮਿਰਚ ਪਾ ਕੇ ਹੋਰ ਚਾਰ ਪੰਜ ਜਿਹੜੀ ਆਪਣੀਆਂ ਚੀਜ਼ਾਂ ਨੇ ਜ ਠੀਕ ਹੈ ਉਹਨਾਂ ਨੂੰ ਮਿਲਾ ਕੇ ਉਹਨਾਂ ਨੂੰ ਅੱਧੇ ਘੰਟੇ ਤੱਕ ਉਬਾਲਦਾ ਅੱਧਾ ਘੰਟਾ ਉਬਾਲਣ ਤੋਂ ਬਾਅਦ ਅੱਧਾ ਘੰਟਾ ਉਬਾਲਣ ਤੋਂ ਬਾਅਦ ਫਿਰ ਉਹਨੂੰ ਠੰਡਾ ਕਰਦਾ ਥੋੜ੍ਹਾ ਜਿਹਾ ਠੰਡਾ ਕਰਨ ਤੋਂ ਬਾਅਦ ਫਿਰ ਉਹਨੂੰ ਪੀਂਦਾ ਤਾਂ ਕਿ ਜੋ ਸਰਦੀਆਂ ਵਗੈਰਾ ਜਿਵੇਂ ਤੁਹਾਨੂੰ ਪਤਾ ਜ਼ੁਕਾਮ ਵਗੈਰਾ ਆਮ ਹੈ ਜੋ ਕਾੜ੍ਹਾ ਉਹ ਮੈਨੂੰ ਬੜਾ ਅੰਦਰੋਂ ਆਰਾਮ ਦਿੰਦਾ ਤਾਂ ਉਹ ਕਾੜ੍ਹੇ ਨੂੰ ਮੈਂ ਮੰਨ ਲਉ ਕਿ ਸਰਦੀਆਂ ਦੇ ਵਿੱਚ ਤਾਂ ਮੰਨ ਲਉ ਕਿ ਜ਼ਿਆਦਾਤਰ ਕਾੜ੍ਹਾ ਹੀ ਪੀਂਦਾ ਤਾਂ ਕਿ ਮੈਨੂੰ ਬਿਮਾਰੀ ਘੱਟ ਤੋਂ ਘੱਟ ਲੱਗੇ ਅਗਰ ਮੈਂ ਕਦੇ ਬਿਮਾਰ ਹੁੰਦਾ ਫਿਰ ਤਾਂ ਫਿਰ ਮੈਂ ਡਾਕਟਰ ਕੋਲ ਜਾ ਕੇ ਦਵਾਈ ਲੈਂਦਾ ਜ਼ਿਆਦਾਤਰ ਦਵਾਈ ਦਾ ਕੋਰਸ ਹੀ ਕਰਦਾ ਐਵੇਂ ਨਹੀਂ ਕਿ ਇੱਕ ਵਾਰੀ ਲੈ ਲਈ ਜਾਂ ਦੋ ਦੋ ਖੁਰਾਕਾਂ ਲੈ ਲਈਆਂ ਪਰ ਮੈਂ ਚਾਹੁੰਦਾ ਕਿ ਹਫਤੇ ਦਾ ਇੱਕ ਪੂਰਾ ਕੋਰਸ ਹੁੰਦਾ ਜਿਵੇਂ ਡਾਕਟਰ ਰਿਕਮੈਂਡ ਕਰਦੇ ਨੇ ਤਾਂ ਉਹ ਪੂਰਾ ਕੋਰਸ ਹੀ ਕਰਦਾ ਮੈਂ ਐਵੇਂ ਨਹੀਂ ਹੈ ਕਿ ਅੱਧਾ ਬੱਧ ਅੱਧ ਵਿੱਚ ਅੱਧਾ ਪਚੱਧਾ ਵਿੱਚ ਕਰਕੇ ਛੱਡ ਦਿਆਂ ਠੀਕ ਹੈ ਜੀ ਇਸ ਤੋਂ ਇਲਾਵਾ ਦੇਸੀ ਨੁਸਖਾ ਜੇ ਕੋਈ ਹੋਰ ਪੁੱਛੋਂਗੇ ਤੁਸੀਂ ਤਾਂ ਹਾਂ ਇੱਕ ਦੇਸੀ ਨੁਸਖਾ ਇਹ ਵੀ ਕਰਦਾਂ ਕਿ ਮੈਂ ਜਦੋਂ ਕੋਈ ਬਿਮਾਰੀ ਬਿਮਾਰ ਹੁੰਦਾ ਤਾਂ ਮੈਂ ਗਰਮ ਪਾਣੀ ਨਾਲ ਨਹਾਉਣਾ ਮੈਨੂੰ ਬੜਾ ਪਸੰਦ ਹੈ ਉਸ ਦੇ ਨਾਲ ਮੈਨੂੰ ਐਵੇਂ ਲੱਗਦਾ ਕਿ ਮੇਰਾ ਜਿਹੜਾ ਸ ਸਰੀਰ ਹੈ ਜਿਹੜਾ ਟੁੱਟ ਬਿਮਾਰੀ ਦੇ ਵਿੱਚ ਬੜਾ ਥੱਕਿਆ ਥੱਕਿਆ ਮਹਿਸੂਸ ਕਰਦਾ ਉਹਨੂੰ ਥੋੜ੍ਹਾ ਜਿਹਾ ਅੱਛਾ ਫੀਲ ਹੁੰਦਾ ਨਹਾ ਕੇ ਗਰਮ ਪਾਣੀ ਨਾਲ ਸਪੈਸ਼ਲੀ ਗਰਮ ਪਾਣੀ ਨਾਲ ਨਹਾਉਂਦਾ ਦੂਸਰੀ ਗੱਲ ਏ ਸੀ ਊਸੀ ਮੈਂ ਬਿਮਾਰੀ ਦੇ ਵਿੱਚ ਬੜਾ ਅਵੋਇਡ ਕਰਦਾਂ ਏ ਸੀ ਊਸੀ ਦੇ ਵਿੱਚ ਨਹੀਂ ਬਹਿੰਦਾ ਠੀਕ ਹੈ ਜੀ ਬਸ ਆਹ ਤਿੰਨ ਚਾਰ ਤਿੰਨ ਚਾਰ ਨੁਸਖੇ ਨੇ ਜਿਹੜੇ ਮੈਂ ਫੋਲੋ ਕਰਦਾ ਇਸ ਤੋਂ ਇਲਾਵਾ ਤਾਂ ਇਹੋ ਜਿਹਾ ਕੋਈ ਨੁਸਖਾ ਹੈ ਨਹੀਂ ਜਿਹੜਾ ਮੈਂ ਤੁਹਾਨੂੰ ਦੱਸ ਸਕਾਂ ਹੋਰ ਬਾਕੀ ਜਦੋਂ ਕੋਈ ਮੇਰੇ ਦਿਮਾਗ ਵਿੱਚ ਆਇਆ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਠੀਕ ਹੈ ਜੀ ਆਹੀ ਨੇ ਅਤੇ ਬਸ ਮੈਂ ਚਾਹੁੰਦਾ ਕਿ ਤੁਸੀਂ ਵੀ ਕਾੜ੍ਹੇ ਵਾਲਾ ਜਿਹੜਾ ਮੈਂ ਤੁਹਾਨੂੰ ਨੁਸਖਾ ਪਹਿਲਾਂ ਦੱਸਿਆ ਨਾ ਉਹ ਤਾਂ ਤੁਸੀਂ ਜ਼ਰੂਰ ਕਰੋ ਕਿਉਂਕਿ ਕਾੜ੍ਹੇ ਵਾਲਾ ਨੁਸਖਾ ਬੜਾ ਮੇਨ ਹੈ ਜੇ ਤੁਸੀਂ ਕਾੜ੍ਹਾ ਹਰ ਸਰਦੀ ਪੂਰਾ ਪੀਂਦੇ ਹੋ ਵੈਸੇ ਤੁਹਾਡਾ ਸਰੀਰ ਠੀਕ ਰਹੇਗਾ ਜ਼ਰੂਰੀ ਨਹੀਂ ਹੈ ਕਿ ਜਦੋਂ ਤੁਸੀਂ ਬਿਮਾਰ ਹੋ ਤਦ ਹੀ ਕਾੜ੍ਹਾ ਪੀਣਾ ਬਿਨਾ ਬਿਮਾਰੀ ਤੋਂ ਵੀ ਕਾੜ੍ਹਾ ਪੀਣਾ ਬਹੁਤ ਜ਼ਰੂਰੀ ਹੈ ਡਾਕਟਰ ਰਿਕਮੈਂਡ ਵੀ ਕਰਦੇ ਨੇ ਕਿ ਕਾੜ੍ਹਾ ਜ਼ਰੂਰ ਪੀਉ ਤਾਂ ਠੀਕ ਹੈ ਕਾੜ੍ਹਾ ਜ਼ਰੂਰ ਪੀਣਾ ਚਾਹੀਦਾ ਅਤੇ ਆਪਣੇ ਪਾਣੀ ਅਤੇ ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਤਾਂ ਕਿ ਜੇ ਤੁਹਾਡੇ ਸਰੀਰ 'ਤੇ ਕੋਈ ਕਿਉਂਕਿ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਆਪਣੇ ਤੁਹਾਨੂੰ ਪਤਾ ਬੈਕਟੀਰੀਆ ਵਗੈਰਾ ਆਪਣੇ ਨਾਲੋਂ ਬਾਡੀ ਦੇ ਨਾਲ ਹੁੰਦੇ ਨੇ ਤਾਂ ਬੈਕਟੀਰੀਆ ਜਦੋਂ ਗਰਮ ਨਾਲ ਨਹਾਉਂਦੇ ਹੋ ਤਾਂ ਬੈਕਟੀਰੀਆ ਖਤਮ ਹੁੰਦਾ ਉਹਨਾਂ ਦਾ ਤਾਂ ਉਹ ਬਹੁਤ ਜ਼ਰੂਰੀ ਗੱਲ ਹੈ ਠੀਕ ਹੈ ਜੀ ਓਕੇ